ਹੈਲੋ ਕੰਨਟੀਨ ਸਰਵਿਸ ਹਾਂਜੀ ਮੈਮ ਦੱਸੋ ਹਾਂਜੀ ਅਸੀਂ ਕੀ ਹੈਲਪ ਕਰ ਸਕਦੇ ਹਾਂ ਖਾਣ ਦੇ ਵਿੱਚ ਸਾਡੇ ਕੋਲ ਕੌਫੀ ਚਾਹ ਬਟਰ ਚਿਕਨ ਅਂ ਸਮੋਸਾ ਡੋਸਾ ਇਸ਼ਟ ਇਡਲੀ ਬਿਸਕਿਟ ਐਂਡ ਨੂਡਲਸ ਤੁਸੀਂ ਆਪਣਾ ਔਡਰ ਦਿਓ ਜੀ ਹਾਂਜੀ ਹਾਂਜੀ ਗਿਆਰਾਂ ਤੋਂ ਪਹਿਲਾਂ ਹੀ ਮਿਲ ਜਾਊਗਾ ਔਡਰ ਕੋਲਡ੍ਰਿੰਕ ਕੌਫੀ ਕੋਲਡ ਕੌਫੀ ਹੌਟ ਕੌਫੀ ਤੁਸੀਂ ਦੱਸੋ ਮੈਮ ਆਪਣਾ ਔਡਰ ਦਿਓ ਤੁਸੀਂ ਹਾਂਜੀ ਡੰਨ ਓਕੇ ਠੀਕ ਹੈ ਅਤੇ ਸਨੈਕਸ ਦੇ ਵਿੱਚ ਕੀ ਕਰ ਗਈ ਹਾਂਜੀ ਹਾਂਜੀ ਆ ਤੁਹਾਨੂੰ ਗਿਆਰਾਂ ਵਜੇ ਤੱਕ ਚਾਹੀਦਾ ਜੀ ਬਸ ਤੁਸੀਂ ਜਾਂ ਟੈਨ ਫੋਟੀ ਫਾਇਵ ਤੱਕ ਆਪਣਾ ਕਿਸੇ ਨੂੰ ਭੇਜ ਦੇਣਾ ਕਿ ਅਸੀਂ ਰ ਓਕੇ ਡਿਲੀਵਰੀ ਕਰ ਦਵਾਂਗੇ ਜੀ ਤੁਸੀਂ ਆਪਣਾ ਕਿ ਪ੍ਰੋਪਰ ਡਿਪਾਰਟਮੈਂਟ ਦਾ ਜਿਹੜਾ ਹੈਗਾ ਇਹਦਾ ਵੀ ਸੈਮੀਨਾਰ ਕਿੱਥੇ ਹੋ ਰਿਹਾ ਸਾਰਾ ਅਡਰੈਸ ਕਰ ਦਿਓ ਸੈਂਡ ਜਾਂ ਵੀ ਇੱਕ ਵਾਰੀ ਦੇ ਜਾਓ ਆ ਕੇ ਹਾਂਜੀ ਅਤੇ ਮੈਂ ਤੁਹਾਨੂੰ ਪੇਮੈਂਟ ਜਿਹੜੀ ਹੈਗੀ ਹੈਗੀ ਦਕ ਦੱਸ ਜਾਣਿਆ ਦੀ ਕਿੰਨੀ ਬਣੂਗੀ ਇਹਨਾਂ ਦੀ ਸਾਰੀ ਦੀ ਅਤੇ ਤੁਸੀਂ ਔਨਲਾਈਨ ਕਰ ਦਿਓਗੇ ਤਾਂ ਬਹੁਤ ਵਧੀਆ ਹੋਊਗਾ ਨਹੀਂ ਫਿਰ ਕੈਸ਼ ਵੀ ਤਾਂ ਹੋ ਹੀ ਜਾਊਗਾ ਠੀਕ ਹੈ ਅਤੇ ਤੁਸੀਂ ਇੱਕ ਹੋਰ ਤੁਸੀਂ ਡਿਸਪੋਜਲ ਲਵੋਗੇ ਕਿ ਉਹ ਤੁਹਾਡੇ ਕੋਲ ਹੈਗਾ ਓਕੇ ਠੀਕ ਠੀਕ ਹੈ ਓਕੇ ਤੁਹਾਡੇ ਤੀਕਰ ਸਮਾਨ ਜਿਹੜਾ ਹੈਗਾ ਬਹੁਤ ਜਲਦੀ ਪਹੁੰਚ ਜਾਊਗਾ ਸਾਨੂੰ ਆਸ ਆ ਕਿ ਤੁਹਾਨੂੰ ਸਾਡਾ ਸਮਾਨ ਜਿਹੜਾ ਹੈਗਾ ਬਹੁਤ ਜ਼ਿਆਦਾ ਪਸੰਦ ਆਊਗਾ ਓਕੇ